ਘਰ ਤੋਂ ਆਉਣ ਜਾਣ ਸਮੇਂ ਮੈਂ ਜੁੱਤਿਆਂ ਦੀ ਹੀ ਵਰਤੋਂ ਕਰਦਾ ਹਾਂ ਜੁੱਤਿਆਂ ਰਾਹੀਂ ਪੈਰਾਂ 'ਤੇ ਕੋਈ ਸੱਟ ਜਾਂ ਕੁਝ ਇੱਦਾਂ ਦਾ ਨਹੀਂ ਲੱਗਦਾ ਜਿਸ ਨਾਲ ਪੈਰਾਂ 'ਤੇ ਕੋਈ ਜ਼ਖ਼ਮ ਹੋ ਜਾਵੇ ਅਤੇ ਮੈਂ ਘਰ ਮੈਂ ਘਰ ਵਿੱਚ ਖੁੱਲ੍ਹੇ ਕੱਪੜੇ ਹੀ ਪਹਿਨਦਾ ਅਤੇ ਬਾਹਰ ਵੀ ਖੁੱਲ੍ਹੇ ਕੱਪੜੇ ਹੀ ਪਹਿਨਦਾ ਹਾਂ ਜਿਸ ਨਾਲ ਮੇਰਾ ਉੱਠਣਾ ਬਹਿਣਾ ਤੇ ਤੁਰਨਾ ਫਿਰਨਾ ਸੌਖਾ ਹੁੰਦਾ ਹੈ ਤੇ ਕੱਪੜੇ ਫੱਟਣ ਦਾ ਵੀ ਡਰ ਘੱਟ ਰਹਿੰਦਾ ਹੈ